ਮੈਂ ਸ਼ੇਅਰ ਮਾਰਕਿਟ ਬਾਰੇ ਜਾਣਦਾ ਹਾਂ ਲੇਕਿਨ ਇਹ ਸ਼ੇਅਰ ਮਾਰਕਿਟ ਘਾਟੇ ਵਿੱਚ ਹੀ ਜਾਂਦੀ ਹੈ ਉਲਿੰਪ ਟਰੇਡ ਦਾ ਸ਼ੇਅਰ ਹੈ ਇਨਵੈਸਟਮੈਂਟ ਕੀਤੀ ਜਾਂਦੀ ਹੈ ਜਿਹਦੇ ਵਿੱਚ ਫੋਨ ਦੇ ਉੱਤੇ ਹੀ ਇਨਵੈਸਟਮੈਂਟ ਕੀਤੀ ਜਾਂਦੀ ਹੈ ਇਹ ਸ਼ੇਅਰ ਮਾਰਕਿਟ ਚੰਗੀ ਵੀ ਹੈ ਲੇਕਿਨ ਚੰਗੀ ਵੀ ਨਹੀਂ ਹੈ ਜੂਆ ਟਾਈਪ ਹੈ ਇਹਦੇ ਵਿੱਚ ਕਈ ਬੱਚੇ ਆਪਣੇ ਘਰ ਦਾ ਸਭ ਕੁਛ ਬਰਬਾਦ ਕਰ ਲੈਂਦੇ ਹਨ